ਖੇਡਾਂ ਲੋਕਾਂ ਦੀਆਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਬਹੁਤ ਹੀ ਸੋਹਣਾ ਯੋਗਦਾਨ ਪਾਉਂਦੀਆਂ ਨੇ ਜਦੋਂ ਨੌਜਵਾਨ ਖੇਡਣ ਲਈ ਗਰਾਊਂਡ ਦੇ ਵਿੱਚ ਜਾਂਦੇ ਨੇ ਅਤੇ ਸਾਰੇ ਇੱਕ ਜਗ੍ਹਾ ਰਲ ਮਿਲ ਕੇ ਜਦੋਂ ਖੇਡਦੇ ਨੇ ਅਤੇ ਸਰੀਰਕ ਤੌਰ 'ਤੇ ਵੀ ਤੰਦਰੁਸਤ ਅਤੇ ਬਲਵਾਨ ਹੁੰਦੇ ਨੇ ਅਤੇ ਹਾਸਾ ਠੱਠਾ ਕਰਕੇ ਆਪਣਾ ਮਾਨਸਿਕ ਤਣਾਅ ਵੀ ਦੂਰ ਕਰ ਲੈਂਦੇ ਨੇ ਖੇਡਾਂ ਨਾਲ ਹੀ ਆਪਸੀ ਪਿਆਰ ਸਾਂਝ ਨੌਜਵਾਨਾਂ ਵਿੱਚ ਵੱਧਦੀ ਹੈ ਅਤੇ ਉਹ ਸਰੀਰਕ ਰੂਪ ਵਿੱਚ ਵੀ ਤੰਦਰੁਸਤ ਹੁੰਦੇ ਨੇ ਅਤੇ ਮਾਨਸਿਕ ਰੂਪ ਵਿੱਚ ਵੀ ਬਲਵਾਨ ਹੁੰਦੇ ਨੇ ਖੇਡਾਂ ਨੌਜਵਾਨਾਂ ਵਿੱਚ ਪਿਆਰ ਮੁਹੱਬਤ ਅਤੇ ਉਹਨਾਂ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾਉਂਦੀਆਂ ਨੇ ਅੱਜ ਕੱਲ੍ਹ ਦੇ ਨੌਜਵਾਨ ਵੱਖ ਵੱਖ ਖੇਡਾਂ ਜਿਵੇਂ ਕਬੱਡੀ ਕ੍ਰਿਕਟ ਫੁੱਟਬਾਲ ਅਤੇ ਹੋਰ ਵੀ ਐਕਸਰਸਾਈਜ਼ ਕਰਦੇ ਹੋਏ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਕੇ ਅਤੇ ਮਾਨਸਿਕ ਸਿਹਤ ਵੀ ਮਜ਼ਬੂਤ ਬਣਾਉਂਦੇ ਨੇ ਖੇਡਾਂ ਨੌਜਵਾਨਾਂ ਦਾ ਆਪਸੀ ਸਾਂਝ ਵੀ ਮਜ਼ਬੂਤ ਕਰਦੀਆਂ ਨੇ